ਇੱਕ ਤੈਰਾਕ ਲਈ ਜਿਹੜੀ ਡਾਇਟ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਡਾਇਟ ਵਿੱਚ ਪ੍ਰੋਟੀਨ ਜਿਵੇਂ ਆਂਡੇ ਅਤੇ ਜਿਹੜਾ ਦੁੱਧ ਹੈ ਉਹਦਾ ਜਿਹੜਾ ਸੇਵਨ ਹੈ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੇ ਪ੍ਰੋਟੀਨ ਹੈਗੇ ਆ ਉਹ ਸਰੀਰ ਵਿੱਚ ਵੱਧ ਤੋਂ ਵੱਧ ਜਾਨ ਪਾਉਂਦੇ ਆ ਇਸ ਤੋਂ ਇਲਾਵਾ ਜਿਹੜਾ ਸਰੀਰ ਹੈ ਉਹ ਸਲਿਮ ਰਹਿੰਦਾ ਕਿਉਂਕਿ ਜਿਹੜਾ ਮੋਟਾ ਆਦਮੀ ਹੈ ਉਹਨੂੰ ਤੈਰਨ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ ਅਤੇ ਜਿਹੜੇ ਕੁਝ ਘਰੇਲੂ ਜਿਹੜੇ ਖਾਣੇ ਆ ਉਹ ਹੈਗੇ ਆ ਆਪਣੇ ਪ੍ਰੋਟੀਨਸ ਹੋ ਗਏ ਦਾਲਾਂ ਹੋ ਗਈਆਂ ਹਾਈ ਫੈਟੀ ਦੁੱਧ ਹੋ ਗਿਆ ਇਹਦਾ ਜਿਹੜਾ ਸੇਵਨ ਹੈ ਉਹ ਜਿਹੜਾ ਤੈਰਾਕ ਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਤਾਂ ਕਿ ਉਹਦਾ ਜਿਹੜਾ ਸਟੈਮਿਨਾ ਹੈ ਵੱਧ ਤੋਂ ਬਣ ਸਕੇ ਵੱਧ ਤੋਂ ਵੱਧ ਬਣ ਸਕੇ ਇੱਕ ਜਿਹੜਾ ਤੈਰਾਕ ਹੈ ਜੇਕਰ ਉਹ ਮਤਲਬ ਜ਼ਿਆਦਾ ਫੈਟੀ ਚੀਜ਼ਾਂ ਖਾਏਗਾ ਤਾਂ ਜੇਕਰ ਉਹਦਾ ਸਿਰਫ ਸਰੀਰ ਹੈ ਜ਼ਿਆਦਾ ਫੈਟੀ ਹੋਏਗਾ ਤਾਂ ਉਹ ਤਰ ਨਹੀਂ ਸਕਦਾ ਇਸ ਲਈ ਮਤਲਬ ਉਹਦਾ ਇੱਕ ਤਾਂ ਉਹਦੀ ਹਾਈਟ ਜ਼ਿਆਦਾ ਹੋਣੀ ਚਾਹੀਦੀ ਹੈ ਪਲਸ ਉਹ ਸਲੀਮ ਹੋਣਾ ਚਾਹੀਦਾ ਇਸ ਲਈ ਜਿਹੜਾ ਤੈਰਾਕ ਹੈ ਉਹ ਵੱਧ ਤੋਂ ਵੱਧ ਮਤਲਬ ਕੀ ਆ ਮਤਲਬ ਪ੍ਰੋਟੀਨ ਦਾ ਜਿਹੜਾ ਦੁੱਧ ਦਾ ਸੇਵਨ ਕਰਨਾ ਚਾਹੀਦਾ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ